ਹਾਂਜੀ ਸਾਡੇ ਅਨੁਸਾਰ ਤਾਂ ਭੰਗੜਾ ਐਰੋਬਿਕਸ ਨੂੰ ਬਹੁਤ ਮਜ਼ੇਦਾਰ ਬਣਾਉਂਦਾ ਪਤਾ ਕਿੱਦਾਂ ਪਹਿਲੇ ਟਾਈਮ ਦੇ ਉੱਪਰ ਗੁਰਦਾਸ ਮਾਨ ਸੀ ਜਿਹੜਾ ਉਹ ਤਾਂ ਭੰਗੜੇ ਦੀ ਜਾਨ ਸੀ ਉਹ ਜਿੱਥੇ ਜਾਂਦੇ ਸੀ ਉਹਨਾਂ ਨੇ ਗਾਣੇ ਬੋਲਣੇ ਅਤੇ ਭੰਗੜੇ ਤਾਂ ਆਪ ਹੀ ਪੈਣੇ ਸ਼ੁਰੂ ਹੋ ਜਾਣੇ ਭੰਗੜਾ ਤਾਂ ਬਹੁਤ ਵਧੀਆ ਪਾਉਂਦੇ ਸੀ ਹੁਣ ਅੱਜ ਕੱਲ੍ਹ ਦੇ ਟਾਈਮ 'ਤੇ ਉਹਨਾਂ ਦੀ ਜਗ੍ਹਾ ਦਿਲਜੀਤ ਦੋਸਾਂਝ ਨੇ ਲੈ ਲਈ ਹੈ ਉਹ ਵੀ ਜਦੋਂ ਗਾਣੇ ਬੋਲਦੇ ਨੇ ਪੰਜਾਬੀ ਤਾਂ ਲੋਕੀ ਇੱਦਾਂ ਭੰਗੜੇ ਪਾਉਂਦੇ ਜਿਵੇਂ ਕਿਸੇ ਨੂੰ ਸਿਖਾਉਣ ਦੀ ਲੋੜ ਹੀ ਨਹੀਂ ਬਹੁਤ ਹੀ ਵਧੀਆ ਭੰਗੜਾ ਵਧੀਆ ਪੈਂਦਾ ਮਜਾ ਹੀ ਆ ਜਾਂਦਾ ਖਾਸ ਸੰਗੀਤ ਦੀ ਵਰਤੋਂ ਵੀ ਇਹਨਾਂ ਨੇ ਲੈ ਲਈ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਗਾਣੇ ਦੇਖੋ ਪੰਜਾਬੀ ਗਾਣੇ ਕਿੰਨੇ ਵਧੀਆ ਲੱਗਦੇ ਨੇ ਇੱਦਾਂ ਹੀ ਕੋਈ ਵੀ ਪੰਜਾਬੀ ਗਾਣਾ ਲਾ ਕੇ ਕੋਈ ਭੰਗੜੇ ਪਾਏ ਜੋ ਮਜ਼ੇ ਨਾਲ ਨਾਲੇ ਸਰੀਰ ਫਿਟ ਨਾਲੇ ਸਭ ਕੁਛ ਫਿਟ ਮਜ਼ੇਦਾਰ ਏ ਬ ਜ਼ਿੰਦਗੀ ਨ ਨਾਲੋਂ ਇੰਜੋਏ ਵੀ ਹੁੰਦਾ ਇਹਦੇ ਨਾਲ ਅਤੇ ਨਾਲੇ ਆਪਣੀ ਫਿਟਨੈਸ ਵੀ ਹੁੰਦੀ ਹੈ ਬਸ ਜੀ ਬਹੁਤ ਵਧੀਆ ਭੰਗੜਾ ਬਸ ਸਾਨੂੰ ਸਾਰਿਆਂ ਨੂੰ ਭੰਗੜਾ ਜ਼ਰੂਰ ਪਾਉਣਾ ਚਾਹੀਦਾ ਭੰਗੜਾ ਤਾਂ ਇੱਕ ਬਹੁਤ ਵਧੀਆ ਆਪਣੇ ਸਰੀਰ ਦਾ ਹਿੱਸਾ ਬਣਾਉਣਾ ਚਾਹੀਦਾ ਕਿ ਅਸੀਂ ਜਿੱਦਾਂ ਰੋਟੀ ਖਾਂਦੇ ਹਾਂ ਇੱਦਾਂ ਸਾਨੂੰ ਭੰਗੜਾ ਦਾ ਆਪਣਾ ਰੋਜ਼ ਦੀ ਰੂਟੀਨ 'ਚ ਹਿੱਸਾ ਬਣਾ ਲਓ ਕਿ ਅਸੀਂ ਇੱਕ ਟਾਈਮ ਇੱਕ ਘੰਟਾ ਜਾਂ ਅੱਧਾ ਘੰਟਾ ਅਗਰ ਅਸੀਂ ਭੰਗੜਾ ਪਾਉਂਦੇ ਹਾਂ ਤਾਂ ਸਾਡੇ ਤਾਂ ਸਰੀਰ ਤੁਹਾਨੂੰ ਕਦੇ ਬਿਮਾਰੀ ਨਹੀਂ ਲੱਗੇਗੀ ਕਿਉਂਕਿ ਸਾਡੀ ਪੂਰੀ ਪੂਰਾ ਸਰੀਰ ਇਹਦੇ ਨਾਲ ਫਿੱਟ ਹੋ ਜਾਏਗਾ ਸਾਰੀ ਮੂਵ ਸਾਡੇ ਸਰੀਰ ਦੀ ਸਾਰੀ ਮਤਲਬ ਹਿਲ ਜੁਲ ਹੋਏਗੀ ਜਿਹਦੇ ਨਾਲ ਸਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਸਾਡੀਆਂ ਔਰ ਸੰਗੀਤ ਤਾਂ ਬਹੁਤ ਵਧੀਆ ਚਲਦੇ ਰਹਿੰਦੇ ਆ ਅੱਜ ਕੱਲ੍ਹ ਤਾਂ ਮਜ਼ੇਦਾਰ ਸੰਗੀਤ ਹੈ ਪੰਜਾਬੀ ਕਿੰਨਾ ਹੀ ਆਏ ਆ ਜਿਹੜਾ ਲਾਈਏ ਉੱਥੇ ਭੰਗੜਾ ਪੈਣਾ ਸ਼ੁਰੂ ਹੋ ਜਾਂਦਾ